ਮੈਨੂੰ ਪੰਛੀਆਂ ਨਾਲ ਬਹੁਤ ਪਿਆਰ ਹੈ ਮੈਂ ਆਪਣੇ ਘਰ ਦਾ ਆਲਾ ਦੁਆਲਾ ਬਿਲਕੁਲ ਸਾਫ ਰੱਖਦੀ ਹਾਂ ਅਤੇ ਪੰਛੀਆਂ ਦੀ ਸੰਭਾਲ ਰੱਖਣ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਹੈ ਮੈਂ ਆਪਣੇ ਘਰ ਦੇ ਬਾਹਰ ਛੋਟੇ ਛੋਟੇ ਆਲ੍ਹਣੇ ਅਤੇ ਮੈਂ ਛੱਤ ਉੱਪਰ ਵੀ ਉਹਨਾਂ ਦੇ ਰਹਿਣ ਦੀ ਵਿਵਸਥਾ ਕੀਤੀ ਹੋਈ ਹੈ ਮੈਂ ਛੱਤ ਉੱਪਰ ਪਾਣੀ ਦਾਣਾ ਜ਼ਰੂਰ ਪਾਉਂਦੀ ਹਾਂ ਤਾਂ ਕਿ ਜੋ ਇੱਧਰ ਉੱਧਰ ਘੁੰਮ ਰਹੇ ਪਕਸ਼ੀਆਂ ਦਾ ਪੇਟ ਭਰ ਸਕਣ ਅਤੇ ਮੈਨੂੰ ਪੰਛੀਆਂ ਨੂੰ ਦੇਖਣ ਦਾ ਬਹੁਤ ਸ਼ੌਕ ਹੈ ਆਨੰਦ ਮਿਲਦਾ ਹੈ ਸਾਡੇ ਘਰ ਇੱਕ ਬ੍ਰਿਕਸ਼ ਵੀ ਲੱਗਾ ਹੋਇਆ ਹੈ ਜਿਸ 'ਤੇ ਪੰਛੀਆਂ ਨੇ ਆਪਣੇ ਆਲ੍ਹਣੇ ਬਣਾਏ ਹੋਏ ਹਨ ਅਸੀਂ ਉਹਨਾਂ ਦੀ ਸੁਰੱਖਿਆ ਅਤੇ ਸੰਭਾਲ ਵਧੀਆ ਤਰੀਕੇ ਨਾਲ ਕਰਦੇ ਹਾਂ ਤਾਂ ਜੋ ਪੰਛੀ ਤੰਗ ਨਾ ਹੋ ਸਕਣ ਮੈਨੂੰ ਕੁਦਰਤ ਦੀਆਂ ਚੀਜ਼ਾਂ ਨਾਲ ਬਹੁਤ ਪਿਆਰ ਹੈ ਅਤੇ ਉਹਨਾਂ ਦੀ ਦੇਖ ਰੇਖ ਕਰਨ ਵਿੱਚ ਮੈਨੂੰ ਬਹੁਤ ਆਨੰਦ ਮਿਲਦਾ ਹੈ ਜਿਸ ਕਰਕੇ ਮੈਨੂੰ ਜਦੋਂ ਦਾ ਮੈਂ ਆਪਣੇ ਦਾਦਾ ਜੀ ਨੂੰ ਦੇਖਿਆ ਹੈ ਪੰਛੀਆਂ ਦੀ ਸਾਂਭ ਸੰਭਾਲ ਕਰਨਾ ਉਦੋਂ ਤੋਂ ਹੀ ਮੇਰੇ ਮਨ ਵਿੱਚ ਬਹੁਤ ਸ਼ੌਕ ਪੈਦਾ ਹੋਇਆ ਕਿ ਮੈਂ ਵੀ ਇਸ ਤਰ੍ਹਾਂ ਇਹਨਾਂ ਦੀ ਸਾਂਭ ਸੰਭਾਲ ਕਰਾਂ ਅਤੇ ਉਹਨਾਂ ਦਾ ਧਿਆਨ ਰੱਖਾਂ